ਪੰਜਾਬ ਵਿੱਚ ਮਨੋਰੰਜਨ ਦੇ ਕਈ ਢੰਗ ਹਨ ਅਤੇ ਹਰ ਖੇਤਰ ਦੇ ਇਹ ਵੱਖਰੇ ਵੱਖਰੇ ਤਰੀਕੇ ਦੇ ਨਾਲ ਇਹ ਲੋਕ ਆਪਣੇ ਮਨੋਰੰਜਨ ਕਰਦੇ ਹਨ ਜਿਵੇਂ ਸਾਡੀਆਂ ਵਿਆਹੀਆਂ ਹੋਈਆਂ ਕੁੜੀਆਂ ਆਪਣੇ ਪੇਕੇ ਘਰ ਜਾਂਦੀਆਂ ਹਨ ਕਿ ਆਪਣੇ ਸਾਉਣ ਦਾ ਮਹੀਨਾ ਕੱਟਣ ਦੇ ਵਾਸਤੇ ਇਹ ਵੀ ਉਹਨਾਂ ਦਾ ਜਾਣ ਦਾ ਇਹ ਹੈ ਕਿ ਉੱਥੇ ਆਪਣੇ ਪੇਕਿਆਂ ਦੇ ਘਰ ਜਾ ਕੇ ਉੱਥੇ ਫਿਰ ਤੀਆਂ ਲੱਗਦੀਆਂ ਹਨ ਸਾਰੀਆਂ ਕੁੜੀਆਂ ਸਹੇਲੀਆਂ ਦੇ ਨਾਲ ਰਲ ਮਿਲ ਕੇ ਬੈਠਦੀ ਜਾਂਦੀਆਂ ਹਨ ਅਤੇ ਗਿੱਧਾ ਪਾਉਂਦੀਆਂ ਨੇ ਚਰਖੇ ਕੱਤਦੀਆਂ ਨੇ ਬੋਲੀਆਂ ਪਾ ਪਾ ਕੇ ਆਪਣੇ ਮਨ ਦੇ ਜਿਹੜੇ ਸਹੁਰਿਆਂ ਦੇ ਕੋਈ ਮਨ ਦੇ ਵਲਵਲੇ ਹੁੰਦੇ ਹਨ ਉਹ ਇੱਕ ਦੂਜੇ ਨੂੰ ਉਹ ਬੋਲੀ ਦੇ ਰਾਹੀਂ ਉਹ ਦਰਸਾਉਂਦੀਆਂ ਹਨ ਇਸ ਤਰ੍ਹਾਂ ਹੀ ਜਦੋਂ ਰਲ ਮਿਲ ਕੇ ਡਾਂਸ ਕਰਦੀਆਂ ਹਨ ਲੁੱਡੀ ਪਾ ਲੁੱਡੀ ਪਾਉਂਦੀਆਂ ਹਨ ਝੂਮਰ ਕਰਦੀਆਂ ਹਨ ਗਿੱਧਾ ਪਾਉਂਦੀਆਂ ਹਨ ਅਤੇ ਉਹ ਵੀ ਉਹਨਾਂ ਨੂੰ ਆਪਸ ਦੇ ਵਿੱਚ ਰਲ ਮਿਲ ਕੇ ਚੰਗਾ ਲੱਗਦਾ ਹੈ ਇਸੇ ਦੇ ਰਾਹੀਂ ਸਾਡੇ ਜਿਹੜੇ ਮਰਦ ਹਨ ਉਹ ਭੰਗੜਾ ਪਾਉਂਦੇ ਹਨ ਅਤੇ ਉਹ ਭੰਗੜੇ ਦੇ ਰਾਹੀਂ ਜਿਵੇਂ ਵੱਖਰੇ ਵੱਖਰੇ ਆਪਣੇ ਇੱਕ ਦੂਜੇ ਦੇ ਨਾਲ ਉਹ ਮੁਕਾਬਲੇ ਕਰਦੇ ਹਨ ਔਰ ਇਹਦੇ ਨਾਲ ਉਹਨਾਂ ਨੂੰ ਚੰਗਾ ਲੱਗਦਾ ਹੈ ਕਿ ਉਹ ਦੂਜਿਆਂ ਦੇ ਨਾਲੋਂ ਕੁਛ ਅੱਗੇ ਹੋ ਗਏ ਆਪਣਾ ਵੱਖਰਾ ਕਰ ਰਹੇ ਹਨ ਅਤੇ ਇਸ ਤਰ੍ਹਾਂ ਹੀ ਉਹਨਾਂ ਦੇ ਇਹ ਮਨੋਰੰਜਨ ਦੇ ਉਹਨਾਂ ਨੇ ਆਪਣੇ ਆਪਣੇ ਸਾਧਨ ਬਣਾਏ ਹੋਏ ਹਨ